ਖੇਤੀ ਪਸ਼ੂ ਪਾਲਣ ਮੱਛੀ ਪਾਲਣ ਡੈਰੀ ਉਤਪਾਦਨ ਖੇਤੀਬਾੜੀ ਦੇ ਵਿੱਚ ਟੈਕਨੋਲੋਜੀ ਨੇ ਬਹੁਤ ਜ਼ਿਆਦਾ ਭੂਮਿਕਾ ਨਿਭਾਈ ਹੈ ਜਿਵੇਂ ਹੁਣ ਖੇਤੀ ਹੈ ਖੇਤੀ ਦੇ ਵਿੱਚ ਕੀ ਹੈ ਪਹਿਲਾਂ ਖੇਤੀ ਹੁੰਦੀ ਸੀ ਜਿਹੜੀ ਉਹ ਬੱਲਦਾਂ ਰੇੜਿਆਂ ਨਾਲ ਕੀਤੀ ਜਾਂਦੀ ਸੀ ਹੁਣ ਟੈਕਨੋਲੋਜੀ ਦੇ ਨਾਲ ਕੀ ਆ ਨਵੇਂ ਨਵੇਂ ਸੰਦ ਜਿਹੜੇ ਖੇਤੀ ਦੇ ਉਹ ਆ ਗਏ ਨੇ ਆਨਲਾਈਨ ਆਪਾਂ ਤਕਨੀਕਾਂ ਦੇਖਦੇ ਹਾਂ ਜਿਹਦੇ ਨਾਲ ਆਪਣਾ ਖੇਤੀ ਦਾ ਉਤਪਾਦਨ ਆ ਜਿਹੜਾ ਬਹੁਤ ਵਧੀਆ ਹੁੰਦਾ ਮੱਛੀ ਪਾਲਣ ਹੈ ਉਹਦਾ ਵੀ ਆਪਾਂ ਟੈਕਨੋਲੋਜੀ ਤੋਂ ਬਹੁਤ ਸਾਰੀਆਂ ਤਕਨੀਕਾਂ ਸਿੱਖਦੇ ਹਾਂ ਜਿਹਦੇ ਨਾਲ ਆਪਾਂ ਮੱਛੀ ਪਾਲਣ ਉਦਯੋਗ ਆ ਜਿਹੜਾ ਉਹਨੂੰ ਬੜਾਵਾ ਦੇ ਸਕਦੇ ਹਾਂ ਆਪਾਂ ਆਪਣਾ ਬਿਜ਼ਨਸ ਕਾਰੋਬਾਰ ਵੱਧ ਚਲਾ ਸਕਦੇ ਹਾਂ ਪਸ਼ੂ ਪਾਲਣ ਵੀ ਪਲ ਪਸ਼ੂਆਂ ਦੀ ਖੁਰਾਕਾਂ ਨੇ ਜਿਹੜੀਆਂ ਆਪਾਂ ਨੂੰ ਆਨਲਾਈਨ ਦੇਖ ਸਕਦੇ ਹੈਗੇ ਆਨਲਾਈਨ ਆਪਾਂ ਉਹਨਾਂ ਤੋਂ ਨੋਲੇਜ ਲੈ ਕੇ ਪਸ਼ੂਆਂ ਦੇ ਦੁੱਧ ਵਿੱਚ ਵਾਧਾ ਕਰ ਸਕਦੇ ਹਾਂ ਅਤੇ ਆਪਾਂ ਜਿਹੜਾ ਡੈਰੀ ਫਾਰਮ ਹੈਗਾ ਡੈਰੀ ਉਤਪਾਦਨ ਹੈ ਉਹਨੂੰ ਚੰਗੀ ਤਰ੍ਹਾਂ ਵਧਾ ਸਕਦੇ ਹਾਂ ਇਹ ਕਿਹਦੇ ਕਰਕੇ ਹੋਇਆ ਗਾ ਟੈਕਨੋਲਜੀ ਕਰਕੇ ਜੇ ਆਪਣੇ ਕੋਲ ਟੈਕਨੋਲੋਜੀ ਨਾ ਹੁੰਦੀ ਤਾਂ ਸ਼ਾਇਦ ਆਪਾਂ ਇਹਨਾਂ ਉਦਯੋਗਾਂ ਦੇ ਵਿੱਚ ਓਨਾ ਵਧੀਆ ਲਾਹਾ ਨਾ ਲੈ ਸਕਦੇ ਇਸ ਕਰਕੇ ਟੈਕਨੋਲੋਜੀ ਨੂੰ ਆਪਾਂ ਬਹੁਤ ਵਧੀਆ ਸਮਝਦੇ ਹਾਂ ਜੇ ਟੈਕਨੋਲੋਜੀ ਆਈ ਤਾਂ ਆਪਣੇ ਸਾਰੇ ਉਤਪਾਦਨਾਂ ਦੇ ਵਿੱਚ ਬਹੁਤ ਜ਼ਿਆਦਾ ਤਰੱਕੀ ਕੀਤੀ ਅਤੇ ਇਸ ਕਰਕੇ ਆਪਾਂ ਕਹਿ ਸਕਦੇ ਹਾਂ ਵੀ ਜਿਹੜੀ ਟੈਕਨੋਲੋਜੀ ਹੈਗੀ ਉਹ ਅੱਜ ਦੇ ਖੇਤਰ ਦੇ ਵਿੱਚ ਸਾਰੇ ਹੀ ਉਦਯੋਗਾਂ ਦੇ ਵਿੱਚ ਸਾਰੇ ਬਿਜਨਸ ਕਾਰੋਬਾਰਾਂ ਦੇ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ ਜਿਹਦੇ ਕਰਕੇ ਜਿਹੜੇ ਲੋਕ ਨੇ ਉਹ ਆਪਣੇ ਕਾਰੋਬਾਰ ਨੂੰ ਬਹੁਤ ਹੱਦ ਤੱਕ ਵਧੀਆ ਚਲਾ ਸਕਦੇ ਨੇ ਅਤੇ ਉਹਨਾਂ ਦੀਆਂ ਸਮੱਸਿਆਵਾਂ ਦਾ ਹੱਲ ਸੌਖਾ ਮਿਲ ਜਾਂਦਾ ਅਤੇ ਆਪਾਂ ਇਹ ਕਹਿ ਸਕਦੇ ਹਾਂ ਕਿ ਵੀ ਟੈਕਨੋਲੋਜੀ ਦੇ ਕਾਰਨ ਇਹ ਸਾਰੇ ਬਿਜਨਸ ਨੇ ਜਿਹੜੇ ਉਹ ਕਰਨੇ ਹੁਣ ਬਹੁਤ ਸੌਖੇ ਹੋ ਗਏ ਨੇ